ਸ਼ਹੀਦ ਭਗਤ ਸਿੰਘ ਨਗਰ ਦਾ ਪਹਿਲਾ ਨਾਮ ਨਵਾਂਸ਼ਹਿਰ ਸੀ ਅਤੇ ਬਾਅਦ ਵਿੱਚ ਇਸ ਦਾ ਨਾਮ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ ਗਿਆ ਕਿਉਂਕਿ ਸ਼ਹੀਦ ਭਗਤ ਸਿੰਘ ਦਾ ਜਨਮ ਪਿੰਡ ਖਟਕੜ ਕਲਾਂ ਵਿੱਚ ਹੋਇਆ ਸੀ ਜੋ ਕਿ ਜ਼ਿਲ੍ਹਾ ਨਵਾਂਸ਼ਹਿਰ ਵਿੱਚ ਸਥਿਤ ਹੈ ਇੱਥੇ ਇੱਕ ਅਜਾਇਬ ਘਰ ਬਣਾਇਆ ਗਿਆ ਇਸ ਵਿੱਚ ਦਰਸਾਇਆ ਗਿਆ ਕਿਵੇਂ ਸ਼ਹੀਦ ਭਗਤ ਸਿੰਘ ਸ਼ਹੀਦ ਭਗਤ ਸਿੰਘ ਦਾ ਸਾਰਾ ਜੀਵਨ ਇਹਦੇ ਵਿੱਚ ਦਰਸਾਇਆ ਗਿਆ ਕਿਵੇਂ ਸ਼ਹੀਦ ਭਗਤ ਸਿੰਘ ਨੇ ਆਪਣਾ ਜਵ ਜੀਵ ਜਿਹੜਾ ਬਚਪਨ ਹੈ ਬਤੀਤ ਕੀਤਾ ਇਹਦੇ ਵਿੱਚ ਅਤੇ ਉਸ ਤੋਂ ਬਾਅਦ ਫਿਰ ਜਿਹੜਾ ਇਹ ਅਜਾਇਬ ਘਰ ਇਹਨੂੰ ਦੂਰ ਦੂਰ ਤੋਂ ਲੋਕ ਦੇਖਣ ਆਉਂਦੇ ਕੋਈ ਵੀ ਨਵਾਂਸ਼ਹਿਰ ਜਾਂ ਬੰਗਿਆ ਤੋਂ ਲੰਘਦਾ ਇਹਨੂੰ ਦੇਖ ਕੇ ਹੀ ਜਾਂਦਾ ਹੈ ਕਿਉਂਕਿ ਕੋਈ ਵੀ ਬਿਨਾਂ ਦੇਖੇ ਨਹੀਂ ਲੰਘਦਾ ਅਤੇ ਇਸ ਤੋਂ ਇੱਥੋਂ ਪਤਾ ਲੱਗਦਾ ਇੱਥੋਂ ਇ ਇਤਿਹਾਸ ਦਾ ਪਤਾ ਲੱਗਦਾ ਹੈ ਕਿਵੇਂ ਪੁਰਾਣੇ ਪੁਰਾਣਾ ਜ਼ਮਾਨਾ ਜੋ ਵੀ ਸੀ ਇਤਿਹਾਸ ਸਾਰਾ ਪਤਾ ਲੱਗਦਾ ਹੈ ਅਤੇ ਉਸ ਤੋਂ ਬਾਅਦ ਹੁਣ ਜਿਵੇਂ ਸਾਨੂੰ ਸਾਡੇ ਬਜ਼ੁਰਗਾਂ ਅਤੇ ਮਾਪਿਆਂ ਤੋਂ ਪਤਾ ਲੱਗਿਆ ਇਸ ਇਹਦੇ ਬਾਰੇ ਉਵੇਂ ਇਹ ਪੀੜੀ ਤੋਂ ਪੀੜੀ ਦਰ ਚੱਲ ਰਿਹਾ ਹੈ ਅਤੇ ਇਸ ਇਸ ਜ਼ਿਲ੍ਹੇ ਦੇ ਸੱਭਿਆਚਾਰ ਇਹਦੇ ਵਿੱਚ ਕੁੜੀਆਂ ਹੈ ਜਿਹੜੀਆਂ ਪਟਿਆਲਾ ਸੂਟ ਪਾਉਂਦੀਆਂ ਸੋਹਣਾ ਸੋਹਣਾ ਤਿਆਰ ਹੁੰਦੀਆਂ ਟ੍ਰਡੀਸ਼ ਕੋਈ ਵੀ ਜਵੈਲ ਕੋਈ ਪਾਉਂਦੀਆਂ ਸ਼ ਜਿੱਦਾਂ ਸੱਗੀ ਫੁੱਲ ਹੋ ਗਏ ਜਿਵੇਂ ਚੂੜੀਆਂ ਹੋ ਗਈਆਂ ਕੁਛ ਵੀ ਮੁੰਡੇ ਹੈ ਜਿਹੜੇ ਪੱਗ ਬੰਨ੍ਹਦੇ ਅਤੇ ਆਪਣੇ ਜਿਹੜਾ ਸੱਭਿਆਚਾਰ ਹੈ ਉਹਨੂੰ ਦਰਸਾਉਂਦੇ ਹੈ ਅਤੇ ਕੁੜੀਆਂ ਸੋਹਣੀਆਂ ਸੋਹਣੀਆਂ ਤਿਆਰ ਹੁੰਦੀਆਂ ਹੱਥਾਂ 'ਤੇ ਮਹਿੰਦੀਆਂ ਲਾਉਂਦੀਆਂ ਜਾਂ ਸੋਹਣਾ ਸੋਹਣਾ ਪਟਿਆਲਾ ਸੂਟ ਪਾ ਕੇ ਸੋਹਣੀਆਂ ਸੋਹਣੀਆਂ ਤਿਆਰ ਹੁੰਦੀਆਂ ਨਵੇਂ ਨਵੇਂ ਗਹਿਣੇ ਜਿਹੜੇ ਸਾਡੇ ਸੱਭਿਆਚਾਰ ਨੂੰ ਦਰਸਾਉਂਦੇ ਹੈ ਗਹਿਣੇ ਪਾਉਂਦੀਆਂ ਅਤੇ ਇਸ ਨੂੰ ਜਿਹੜਾ ਪੁਰਾਣਾ ਸੱਭਿਆਚਾਰ ਹੈ ਇਹਦੇ ਵਿੱਚ ਜਿਵੇਂ ਫੁਲਕਾਰੀਆਂ ਕੱਢੀਆਂ ਜਾਂਦੀਆਂ ਸੀਗੀਆਂ ਮੰਜੇ ਮੰਜੀਆਂ ਬੁਣੀਆਂ ਜਾਂਦੀਆਂ ਸੀਗੀਆਂ